ਮੈਨੂੰ ਪੇਂਟਿੰਗ ਕਰਨ ਦਾ ਬਚਪਨ ਤੋਂ ਹੀ ਪਸੰਦ ਹੈ ਅਤੇ ਇਸ ਤਰ੍ਹਾਂ ਲਈ ਮੈਂ ਦਿ ਮੈਂ ਦਿਨ ਵਿੱਚ ਵੱਧ ਤੋਂ ਵੱਧ ਸਮਾਂ ਪੇਂਟਿੰਗ ਨੂੰ ਕਰਦੀ ਹਾਂ ਪੇਂਟਿੰਗ ਲਈ ਸਾਨੂੰ ਸਭ ਤੋਂ ਪਹਿਲਾਂ ਤਸਵੀਰ ਆਪਣੇ ਦਿਮਾਗ ਵਿੱਚ ਸੋਚਣੀ ਹੈ ਅਸੀਂ ਤਾਂ ਤਾਂ ਹੀ ਪੇਂਟਿੰਗ ਕਰ ਸਕਦੇ ਹਾਂ ਅਤੇ ਮੈਂ ਜਦੋਂ ਵੀ ਪੇਟਿੰਗ ਕਰਦੀ ਹਾਂ ਤਾਂ ਮੈਂ ਨੇ ਕਈ ਤਸਵੀਰਾਂ ਸੋਚ ਕੇ ਦੀ ਹਾਂ ਅਤੇ ਤਸਵੀਰ ਕੋਈ ਵੀ ਇਮਾਰਤ 'ਤੇ ਕਰ ਸਕਦੀ ਹਾਂ ਅਤੇ ਕੋਈ ਪੇੜ 'ਤੇ ਪੌਦੇ 'ਤੇ ਸੀਨਰੀ 'ਤੇ ਹੋ ਸਕਦੀ ਹੈ ਕੁਦਰਤ ਦੀਆਂ ਚੀਜ਼ਾਂ ਜਿਵੇਂ ਜੀਵ ਜੰਤੂ ਕੋਈ ਜਾਨਵਰ ਜਿਵੇਂ ਮੋਰ ਸ਼ੇਰ ਅਤੇ ਹੋ ਸਕਦੇ ਹਨ ਅਤੇ ਇਸ ਲਈ ਸਾਨੂੰ ਜ਼ਿਆਦਾ ਸਾਰਾ ਦਿਮਾਗ ਵਰਤਣਾ ਪੈਂਦਾ ਹੈ ਇਹ ਤਾਂ ਕਿ ਅਸੀਂ ਸਭ ਤੋਂ ਵਧੀਆ ਤੋਂ ਵਧੀਆ ਪੇਂਟਿੰਗ ਕਰ ਸਕੀਏ ਅਤੇ ਜਿੰਨਾ ਹੀ ਸਮਾਂ ਅਸੀਂ ਕੋਈ ਤਸਵੀਰ ਆਪਣੇ ਦਿਮਾਗ ਵਿੱਚ ਨਹੀਂ ਸੋਚਦੇ ਹਾਂ ਤਾਂ ਪੇਂਟਿੰਗ ਨਹੀਂ ਬਣ ਸਕਦੀ ਸਾਨੂੰ ਕੋਈ ਵੀ ਇਸਦੇ ਤਰ੍ਹਾਂ ਦੀ ਪੇਂਟਿੰਗ ਬਣਾਉਣੀ ਚਾਹੀਦੀ ਹੈ ਕਿ ਜੋ ਇਹ ਦੂਸਰੇ ਲੋਕ ਨੂੰ ਪ੍ਰੇਰਨਾ ਦੇਵੇ ਅਤੇ ਸਾਡੇ ਕੋਲੋਂ ਵਧੀਆ ਤੋਂ ਵਧੀਆ ਸਕੈਚ ਹੋਣ ਅਤੇ ਵਧੀਆ ਹੋਣੇ ਚਾਹੀਦੀ ਹੈ ਅਤੇ ਵਧੀਆ ਤੋਂ ਵਧੀਆ ਚੀਜ਼ਾਂ ਹੋਣ ਜਿਵੇਂ ਕਿ ਸਕੈਚ ਪੈਨ ਕਾਗਜ਼ ਔਰ ਨਾਲ ਅਸੀਂ ਵਧੀਆ ਤੋਂ ਵਧੀਆ ਪੇਂਟਿੰਗ ਬਣਾ ਸਕਦੇ ਹਾਂ ਜਿਵੇਂ ਕਿ ਅਸੀਂ ਵਧੀਆ ਸੂਟ ਵੀ ਪੇਂਟ ਕਰ ਸਕਦੀ ਹਾਂ ਤੇ ਅਤੇ ਆਪਣੇ ਲਈ ਤਿਆਰ ਕਰ ਸਕਦੇ ਹਾਂ